ਯਾਤਰਾ ਦੇ ਸਮੇਂ ਸਾਨੂੰ ਬਹੁਤ ਦਿੱਕਤ ਰਹਿੰਦੀ ਹੈ ਕਿਉਂਕਿ ਹੁਣ ਗੱਡੀਆਂ ਦਾ ਪਿੱਛੇ ਜਿਹੇ ਕੋਈ ਸਹੀ ਟਾਇਮ ਨਹੀਂ ਸੀ ਵਿੱਚ ਹੀ ਰੱਦ ਕਰ ਦਿੰਦੇ ਹੈ ਔਰ ਧਰਨੇ ਲੱਗ ਜਾਂਦੇ ਨੇ ਜਿਨ੍ਹਾਂ ਕਰਕੇ ਅਸੀਂ ਗੱਡੀਆਂ ਦੇ ਉੱਤੇ ਆਵਾਜਾਈ ਨਹੀਂ ਕਰ ਸਕਦੇ ਜ਼ਿਆਦਾ ਔਰ ਬੱਸਾਂ ਦੇ ਰੂਟ ਵੀ ਧਰਨਿਆਂ ਕਰਕੇ ਵੱਡੀਆਂ ਵੱਡੀਆਂ ਸੜਕਾਂ ਦੇ ਧਰਨੇ ਲੱਗੇ ਹੁੰਦੇ ਹਨ ਔਰ ਬੰਦ ਪਈਆਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਆਉਣ ਜਾਣ ਦੇ ਸਾਧਨ ਦੇ ਵਿੱਚ ਬਹੁਤ ਭੀੜ ਭੜੱਕਾ ਹੁੰਦਾ ਹੈ ਅਤੇ ਸਾਰਾ ਸਾਰਾ ਦਿਨ ਕਈ ਕਈ ਧਰਨਿਆਂ ਦੇ ਉੱਤੇ ਖੜ੍ਹੇ ਰਹਿਣਾ ਪੈਂਦਾ ਹੈ ਇਸ ਕਰਕੇ ਸਾਡੇ ਇਲਾਕੇ ਵਿੱਚ ਜੇ ਅਸੀਂ ਆਈਏ ਜਾਈਏ ਤਾਂ ਆਪਦੀ ਖੁਦ ਦੀ ਸਵਾਰੀ ਲੈ ਕੇ ਜਾਣੀ ਪੈਂਦੀ ਸੀ ਜਾਂ ਜਦੋਂ ਵੀ ਲੋਕਡੋਨ ਵਗੈਰਾ ਲੱਗ ਜਾਂਦਾ ਹੈ ਤਾਂ ਵੀ ਸਾਨੂੰ ਆਉਣ ਜਾਣ ਦਾ ਬਹੁਤ ਹੀ ਕਠਨਾਈਆਂ ਪੇਸ਼ ਆਉਂਦੀਆਂ ਹਨ ਇੱਕ ਦੂਜੇ ਸਟੇਟ ਦੇ ਵਿੱਚ ਜਾਣਾ ਆਉਣਾ ਔਰ ਬੱਸਾਂ ਦੇ ਉੱਤੇ ਬਹੁਤ ਭੀੜ ਹੁੰਦੀ ਹੈ ਜੋ ਕਿ ਗਰਮੀਆਂ ਦੇ ਵਿੱਚ ਬੱਚੇ ਔਰ ਬੜੇ ਬੁੱਢੇ ਆਦਮੀਆਂ ਨੁੂੰ ਜਾਣਾ ਆਉਣਾ ਬਹੁਤ ਹੀ ਸਮੱਸਿਆ ਪੈਦਾ ਹੁੰਦੀ ਹੈ ਇਸ ਕਰਕੇ ਸੁਧਾਰ ਵਾਸਤੇ ਹੁਣ ਬੜੀਆਂ ਲ ਲੰਮੀਆਂ ਚੌੜੀਆਂ ਸੜਕਾਂ ਬਣੀਆਂ ਹਨ ਜਿੱਥੇ ਅਜਿਹੇ ਰੂਟ ਹਨ ਕਿ ਜਿੱਥੋਂ ਵੀ ਬੱਸ ਚੱਲੀ ਉੱਥੇ ਜਾ ਕੇ ਆਪਣੀ ਜਗ੍ਹਾ ਦੇ ਉੱਤੇ ਪਹੁੰਚ ਜਾਂਦੀ ਹੈ ਰਸਤੇ ਵਿੱਚ ਜ਼ਿਆਦਾ ਟਰੈਫਿਕ ਦੀ ਸਮੱਸਿਆ ਨਹੀਂ ਆਉਂਦੀ

ਪਹਿਲਾਂ ਵਾਲੇ ਯੁੱਗ ਨੂੰ ਦੇਖ ਕੇ ਅੱਜ ਪਹਿਲਾਂ ਤੋਂ ਬਹੁਤ ਹੀ ਅਸੀਂ ਸੌਖੇ ਹਾਂ ਇਸ ਕਰਕੇ ਜੇ ਪੁਰ ਰੂਟ ਇਸ ਤਰ੍ਹਾਂ ਹੀ ਚੱਲਦੇ ਰਹਿਣ ਤਾਂ ਸਾਨੂੰ ਆਵਾਜਾਈ ਦੇ ਵਿੱਚ ਕੋਈ ਵੀ ਵਿਘਨ ਨਹੀਂ ਪੈਂਦਾ ਅਜਿਹਾ ਕਰਨ ਨਾਲ ਗੋਰਮੈਂਟ ਨੇ ਜੋ ਹੁਣ ਨਵੀਆਂ ਏ ਸੀ ਬੱਸਾਂ ਵਗੈਰਾ ਚਲਾਈਆਂ ਹਨ ਔਰ ਉਹਨਾਂ ਦੇ ਰੂਟ ਵੀ ਬਹੁਤ ਲੰਬੇ ਹੁੰਦੇ ਹਨ ਅਤੇ ਆਵਾਜਾਈ ਦਾ ਸਾਧਨ ਉੱਥੇ ਸੌਖਾ ਹੈ ਜ਼ਿਆਦਾਤਰ ਟ੍ਰੇਨਾਂ ਦਾ ਗੱਡੀਆਂ ਦਾ ਆਉਣਾ ਜਾਣਾ ਸਹੀ ਟਾਇਮ 'ਤੇ ਨਹੀਂ ਬਹੁਤ ਹੀ ਲੇਟ ਚੱਲਦੀਆਂ ਹਨ ਜਿਨ੍ਹਾਂ ਕਰਕੇ ਬਹੁਤ ਭੀੜ ਭੜ ਭੜੱਕਾ ਹੁੰਦਾ ਹੈ ਅਤੇ ਟਾਇਮ ਬਹੁਤ ਘੱਟ ਹਨ ਕਈ ਕਈ ਵਾਰੀ ਤਾਂ ਗੱਡੀਆਂ ਇੱਕ ਦੂਜੇ ਟੈਮ 'ਤੇ ਬੰਦ ਹੀ ਕਰ ਦਿੰਦੇ ਹਨ ਬਈ ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਤਾਂ ਪਰਸੋਂ ਉਸ ਦਿਨ ਤੋਂ ਦੂਜੀ ਟ੍ਰੇਨ ਚੱਲਣੀ ਸ਼ੂਰੁ ਹੋ ਗਈ